ਸਾਨੂੰ ਸ਼ਹਿਰਾਂ ਅਤੇ ਪਿੰਡਾਂ ਦੇ ਕਸਬਿਆਂ ਵਿੱਚ ਮਜ਼ਦੂਰੀ ਦੇ ਮੁੱਦਿਆਂ ਬਾਰੇ ਸਾਡੀ ਇਹ ਰਾਏ ਹੈ ਕਿ ਜਦੋਂ ਅਸੀਂ ਪੰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਆਪਾਂ ਨੌਕਰੀਆਂ 'ਤੇ ਤੇ ਨੌਕਰੀਆਂ 'ਤੇ ਜਿਵੇਂ ਕੋਈ ਸਰਕਾਰੀ ਨੌਕਰੀ ਜਾਂ ਉਹ ਪੜ੍ਹੇ ਲਿਖੇ ਹੋਣ ਕਰਕੇ ਨੌਕਰੀਆਂ ਵਿੱਚ ਲਾਏ ਜਾਂਦੇ ਨੇ ਜਦੋਂ ਉਹਨਾਂ ਨੂੰ ਨੌਕਰੀਆਂ ਮਿਲ ਜਾਣ ਤਾਂ ਫਿਰ ਉਹਨਾਂ ਨੂੰ ਬਾਲ ਮਜ਼ਦੂਰੀ ਤੋਂ ਰੋਕਿਆ ਜਾ ਸਕਦਾ ਹੈ